ਜੇਕਰ ਅਸੀਂ ਪੰਜਾਬੀ ਦੀ ਗੱਲ ਕਰੀਏ ਤਾਂ ਇੱਕ ਇਹ ਬਹੁਤ ਹੀ ਇੱਕ ਮਿੱਠੀ ਭਾਸ਼ਾ ਹੈ ਅਤੇ ਇਹ ਪੂਰੇ ਸੰਸਾਰ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਦੇ ਵਿੱਚ ਨੌਵੇਂ ਨੰਬਰ 'ਤੇ ਆਉਂਦੀ ਹੈ ਇਹ ਸਿਰਫ ਭਾਰਤ ਹੀ ਨਹੀਂ ਇਹ ਪੰ ਪਾਕਿਸਤਾਨ ਦੇ ਵੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾਵਾਂ ਦੇ ਵਿੱਚੋਂ ਇੱਕ ਹੈ ਅਤੇ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਇਹ ਇਹਦੇ ਬਹੁਤ ਸਾਰੀਆਂ ਇਹਦੀਆਂ ਉੱਪ ਭਾਸ਼ਾਵਾਂ ਨੇ ਜਿਵੇਂ ਕਿ ਪਹਿਲੀ ਜਿਹੜੀ ਉਪ ਭਾਸ਼ਾ ਹੈ ਉਹ ਹੈ ਪੁਆਧੀ ਮਲਵਈ ਮਾਝੀ ਅਤੇ ਦੋਆਬੀ ਇਹ ਚਾਰ ਉਪ ਭਾਸ਼ਾਵਾਂ ਨੇ ਅਤੇ ਹਰ ਇੱਕ ਉਪ ਭਾਸ਼ਾ ਵੈਸੇ ਤਾਂ ਇਹਦੀਆਂ ਚਾਰ ਉਪ ਭਾਸ਼ਾ ਨੇ ਪੰਜਾਬੀ ਦੀਆਂ ਪਰ ਹਰ ਇੱਕ ਵੀਹ ਕਿੱਲੋਮੀਟਰ ਦੇ ਅੱਗੇ ਜਾਂਦੇ ਜਾਂਦੇ ਪੰਜਾਬ ਦੇ ਵਿੱਚ ਜਿਹੜੀ ਹੈ ਸਾਡੀ ਜਿਹੜੀ ਪੰਜਾਬੀ ਹੈ ਇਹਦੇ ਟੌਨ ਯਾ ਫਿਰ ਇਹਦੀ ਬੋਲਣ ਦੀ ਜਿਹੜੀ ਬੋਲਣ ਦਾ ਜਿਹੜੀ ਲਹਿਜਾ ਏ ਉਹ ਵੱਖਰਾ ਹੋ ਜਾਂਦਾ ਹੈ ਹਰ ਇੱਕ ਪੰਜਾਬੀ ਦਾ ਲਹਿਜਾ ਏ ਜਿਹੜਾ ਇੱਕ ਦੂਜੇ ਨਾਲ਼ੋਂ ਵੱਖ ਹੈ ਪਰ ਫ਼ਿਰ ਵੀ ਜਿਹੜੀ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਬੜੀ ਹੀ ਪਿਆਰੀ ਬੜੀ ਹੀ ਨਿੱਘੀ ਭਾਸ਼ਾ ਹੈ